ਮੋਹਾਲੀ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਤਾਂ ਚੰਗੀ ਹੈ ਇੱਥੇ ਲੋਕਾਂ ਨੂੰ ਨੇੜੇ ਤੋਂ ਨੇੜੇ ਹਸਪਤਾਲ ਵੀ ਮਿਲ ਜਾਂਦੇ ਹਨ ਅਤੇ ਡੋਕਟਰੀ ਸਹੂਲਤ ਵੀ ਮਿਲ ਜਾਂਦੀ ਹੈ ਪਰ ਉਹ 'ਤੇ ਖਰਚਾ ਕਰਨ ਲਈ ਜਿਵੇਂ ਕਈਆਂ ਕੋਲੋਂ ਉਨੀਂ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਆਪਣੇ ਜੋ ਵੀ ਇਲਾਜ ਕਰਵਾਉਣਾ ਚਾਹੁੰਦੇ ਹਨ ਉਹ ਇਲਾਜ ਕਈ ਵਾਰੀ ਇੰਨਾਂ ਮਹਿੰਗਾ ਹੋ ਜਾਂਦਾ ਹੈ ਕਿ ਉਹ ਇਲਾਜ ਤੋਂ ਬਿਨਾਂ ਹੀ ਆਪਣਾ ਗੁਜ਼ਾਰਾ ਕਰਦੇ ਹਨ ਬਾਕੀ ਭਾਈਚਾਰਕ ਲੋੜਾਂ ਦੇ ਵਿੱਚ ਇੰਨੀ ਮਦਦ ਤਾਂ ਨਹੀਂ ਮਿਲਦੀ ਪਰ ਫਿਰ ਵੀ ਕੋਈ ਬਸ ਹਾਲ ਚਾਲ ਪੁੱਛਣ ਜੋਗਾ ਹੀ ਹੁੰਦਾ ਹੈ ਇਸ ਤੋਂ ਇਲਾਵਾ ਸਹੂਲਤਾਂ ਭਾਵੇਂ ਸਾਰੀਆਂ ਹਨ ਪਰ ਬੰਦਾ ਫਿਰ ਵੀ ਇੱਥੇ ਇਕੱਲਾਪਨ ਹੀ ਮਹਿਸੂਸ ਕਰਦਾ ਹੈ